ਹੈਲੋ ਹਾਂਜੀ ਸਰ ਗੁੱਡ ਈਵਨਿੰਗ ਹਾਂਜੀ ਸਰ ਹੋਰ ਅੱਜ ਕੱਲ੍ਹ ਕੀ ਹਾਲ ਚਾਲ ਚੱਲ ਰਿਹਾ ਐਡਮਿਸ਼ਨ ਦਾ ਫਿਰ ਹਾਂਜੀ ਸਾਡੇ ਤਾਂ ਸਰ ਇਸ ਤਰ੍ਹਾਂ ਵਾ ਕਿ ਸਾਨੂੰ ਪਹਿਲਾਂ ਕਨਵਿਨਸ ਕਰਨਾ ਪੈਂਦਾ ਕਦੇ ਅਸੀਂ ਜਾਂਦੇ ਹਾਂ ਕਦੇ ਅਸੀਂ ਕੁਝ ਕਰਦੇ ਹਾਂ ਕਿ ਬੱਚੇ ਤੁਸੀਂ ਮੈਡੀਕਲ ਲਓਗੇ ਤਾਂ ਇਹ ਬਣੇਗਾ ਨੋਨ ਮੈਡੀਕਲ ਲਓਗੇ ਤਾਂ ਇਹ ਹੋਏਗਾ ਕਮਰਸ ਲਓਗੇ ਤਾਂ ਇਹ ਹੋਏਗਾ ਕਿਉਂਕਿ ਮੈਡੀਕਲ ਨੂੰ ਪਹਿਲਾਂ ਲਓਗੇ ਅਤੇ ਤੁਸੀਂ ਨੋਨ ਮੈਡੀਕਲ 'ਚ ਜਾ ਸਕਦੇ ਹੋ ਕੌਮ ਕਮਰਸ ਲੈ ਕੇ ਤੁਸੀਂ ਉਹਦੇ 'ਚ ਨਹੀਂ ਆ ਸਕਦੇ ਬੜਾ ਹੀ ਸਾਨੂੰ ਸਿਰ ਖਪਾਉਣਾ ਪੈਂਦਾ ਵੈ ਬਟ ਫਿਰ ਵੀ ਜੋ ਹਾਲਾਤ ਨੇ ਕਿਉਂਕਿ ਬੱਚੇ ਜਾਈ ਜਾ ਰਹੇ ਨੇ ਬਾਹਰ ਨੂੰ ਅਤੇ ਇੱਥੋਂ ਉਹਨਾਂ ਨੂੰ ਸਟ੍ਰੀਮ ਦਾ ਜ਼ਿਆਦਾ ਸਮਝ ਆ ਨਹੀਂ ਰਹੀ ਹੈ ਆਰਟਸ ਦੇ ਬਾਰੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਕੁਝ ਨਹੀਂ ਕਰਾਂਗੇ ਉਹ ਹੈਗਾ ਵਾ ਬਿਲਕੁਲ ਨਿਕੰਮਿਆਂ ਦੇ ਲਈ ਪਰ ਕੁਛ ਜਿਹੜੇ ਸਮਝਦਾਰ ਪੇਰੇਂਟਸ ਨੇ ਉਹਨਾਂ ਨੂੰ ਲੱਗਦਾ ਵੀ ਇਹੀ ਹੈ ਕਿ ਨਹੀਂ ਆਰਟਸ ਕਰਕੇ ਇਹ ਆਈ ਏ ਐੱਸ ਆਈ ਪੀ ਐੱਸ ਬਣ ਸਕਦੇ ਨੇ ਮਤਲਬ ਪੇਰੇਂਟਸ ਵੀ ਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੋਸਟਲੀ ਪੇਰੇਂਟਸ ਜਿਹੜੇ ਜਿੰਨੇ ਨਾ ਜ਼ਿਆਦਾ ਪੜ੍ਹੇ ਲਿਖੇ ਨਾ ਹੋਣ ਕਰਕੇ ਓਹਨਾਂ ਨੂੰ ਲੱਗਦਾ ਜੇ ਮੈਡੀਕਲ ਲਓਗੇ ਤਾਂ ਫਿਰ ਉਹ ਡਾਕਟਰ ਹੀ ਬਣਨਾ ਨੋਨ ਮੈਡੀਕਲ ਲਓਗੇ ਤਾਂ ਇੰਜੀਨੀਅਰ ਹੀ ਬ ਉਹਨਾਂ ਨੂੰ ਪਤਾ ਹੀ ਨਹੀਂ ਕਿ ਅੱਜ ਕੱਲ੍ਹ ਕਿੰਨਾ ਹੀ ਵਾਸਟ ਫੀਲਡ ਜਾ ਰਿਹਾ ਹੈ ਅਤੇ ਕਿੰਨਾ ਕੁਝ ਉਹ ਕਰ ਸਕਦੇ ਨੇ ਜੀ ਜੀ ਜੀ ਜੀ ਜੀ ਜੀ ਜੀ ਜੀ ਸਰ ਅਸੀਂ ਜਿੰਨਾ ਮਰਜ਼ੀ ਸਮਝਾ ਲਓ ਪਰ ਅੱਜ ਕੱਲ੍ਹ ਜਿਹੜੇ ਐਡਮਿਸ਼ਨਸ ਨੇ ਇਹ ਸਾਰੇ ਸਟ੍ਰੀਮ ਦੀਆਂ ਡਾਊਨ ਹੀ ਜਾ ਰਹੀਆਂ ਨੇ ਕਿ ਅਸੀਂ ਕੁਛ ਵੀ ਕਰ ਲਈਏ ਹੈ ਨਾ ਸਰ ਜੀ ਚਲੋ ਕੋਸ਼ਿਸ਼ ਤਾਂ ਸਾਡੇ ਵੱਲੋਂ ਵੀ ਚੱਲ ਰਹੀ ਹੈ ਤੁਹਾਡੇ ਵੱਲੋਂ ਵੀ ਚੱਲ ਰਹੀ ਹੈ ਠੀਕ ਹੈ ਸਰ ਜੀ ਚਲੋ ਓਕੇ ਫਿਰ ਦੇਖਦੇ ਹਾਂ ਇੱਕ ਸਕੂਲ ਤੋਂ ਬਾਅਦ ਫਿਰ ਗੱਲ ਕਰਕੇ ਦੇਖਦੇ ਹਾਂ ਵੀ ਕੀ ਬਣਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ ਓਕੇ ਸਰ ਥੈਂਕ ਯੂ ਓਕੇ ਜੀ ਬਾਏ